ਮੇਰੇ ਪਿੰਡ ਦੇ ਸਕੂਲ ਵਿੱਚ ਲਾਈਬ੍ਰੇਰੀ ਹੈ ਬਚਪਨ ਤੋਂ ਹੀ ਮੇਰੇ ਪਿੰਡ ਦੇ ਬੱਚੇ ਉੱਥੇ ਜਾਣਾ ਸ਼ੁਰੂ ਕਰ ਦਿੰਦੇ ਆ ਅਤੇ ਮੈਂ ਵੀ ਉਹਨਾਂ ਚੋਂ ਇੱਕ ਹਾਂ ਜਨ ਮੈਂ ਵੀ ਉੱਥੇ ਜਾਣਾ ਸ਼ੁਰੂ ਕਰਤਾ ਸੀ ਮੈਂ ਉੱਥੇ ਜਾ ਕੇ ਬੈਠ ਜਾਣਾ ਅਤੇ ਕਿਤਾਬਾਂ ਲੈ ਲੈਣੀਆਂ ਹਰ ਰੋਜ਼ ਨਵੀਂ ਤੋਂ ਨਵੀਂ ਕਿਤਾਬ ਹਰ ਰੋਜ਼ ਨਵੀਂ ਤੋਂ ਨਵੀਂ ਕਹਾਣੀ ਪੜ੍ਹਨਾ ਮੈਨੂੰ ਵਧੀਆ ਲੱਗਦਾ ਸੀ ਜਿਨ੍ਹਾਂ ਵਿੱਚੋਂ ਕਿ ਮੈਨੂੰ ਪੰਜ ਤੰਤਰ ਦੀਆਂ ਕਹਾਣੀਆਂ ਅਤੇ ਨਾਲ ਹੀ ਰਾਮਾ ਵਰਗਿਆਂ ਦੀਆਂ ਕਹਾਣੀਆਂ ਮੈਨੂੰ ਬਹੁਤ ਹੀ ਮਨ ਭਾਉਂਦੀਆਂ ਸੀ ਮੈਂ ਬਹੁਤ ਜ਼ਿਆਦਾ ਸ਼ੋਕੀਨ ਸੀ ਪੜ੍ਹਨ ਦਾ ਜਿਨ੍ਹਾਂ ਵਿੱਚੋਂ ਅੱਜ ਵੀ ਮੈਨੂੰ ਕੁਛ ਕੁ ਕਹਾਣੀਆਂ ਵੀ ਯਾਦ ਹੈ ਅਤੇ ਬਹੁਤ ਸਾ ਬਹੁਤ ਸਾਰੀਆਂ ਕਿਤਾਬਾਂ ਦੇ ਨਾਮ ਤੱਕ ਮੈਨੂੰ ਯਾਦ ਹੈ ਜੋ ਇਨਸਾਨ ਦੇ ਜਿਹਨ ਵਿੱਚ ਛਪ ਜਾਂਦਾ ਹੈ ਉਹ ਸਭ ਉਸ ਨੂੰ ਕਿਤਾਬਾਂ ਤੋਂ ਹੀ ਮਿਲਦਾ ਹੈ ਅਤੇ ਕਿਤਾਬਾਂ ਇੱਕ ਮਨੁੱਖ ਦੇ ਜੀਵਨ ਵਿੱਚ ਬਹੁਤ ਵੱਡਾ ਬਦਲਾਅ ਲਿਆ ਦਿੰਦੀਆਂ ਉਹ ਬਚਪਨ ਤੋਂ ਹੀ ਕਿਤਾਬਾਂ ਪੜ੍ਹਦਾ ਪੜ੍ਹਦਾ ਵੱਡਾ ਹੋ ਜਾਂਦਾ ਹੈ ਅਤੇ ਉਸਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਉਹਦਾ ਜੀਵਨ ਕਿੱਥੋਂ ਦਾ ਕਿੱਥੇ ਚਲਾ ਗਿਆ ਉਹ ਆਪਣੀ ਜਵਾਨੀ ਵਿੱਚ ਆਉਂਦਾ ਹੈ ਅਤੇ ਉਦੋਂ ਵੀ ਕਿਤਾਬਾਂ ਪੜ੍ਹਦਾ ਹੈ ਕਿਉਂਕਿ ਕਿਤਾਬਾਂ ਇੱਕ ਇਨਸਾਨ ਦੇ ਜੀਵਨ ਦਾ ਅਜਿਹਾ ਪੜਾਅ ਹੈ ਜੋ ਉਸਨੂੰ ਬਹੁਤ ਅੱਗੇ ਲੈ ਜਾਂਦਾ ਹੈ ਮੈਂ ਵੀ ਆਪਣੀ ਜਵਾਨੀ ਵਿੱਚ ਇੱਕ ਬਹੁਤ ਬੜੀਆ ਵਧੀਆ ਨਾਵਲ ਪੜ੍ਹਿਆ ਜਿਸਦਾ ਨਾਮ ਹੈ ਭੂਤਾਂ ਵਾਲੀ ਹਵੇਲੀ ਓਸ ਉਹ ਲਿਖਿਆ ਹੈਗਾ ਗਾ ਨਿਰਮਲ ਸਿੰਘ ਮਾਨ ਜੀ ਦਾ ਲਿਖਿਆ ਹੋਇਆ ਅਤੇ ਮੈਨੂੰ ਉਸ ਨਾਵਲ ਨੂੰ ਪੜ੍ਹ ਕੇ ਇੰਨਾ ਜ਼ਿਆਦਾ ਸਕੂਨ ਮਿਲਿਆ ਅਤੇ ਮੈਂ ਉਸ ਨਾਵਲ ਤੋਂ ਇੰਨਾ ਜ਼ਿਆਦਾ ਇੰਸਪਾਇਰ ਹੋਇਆ ਨਾ ਕਿ ਮੈਂ ਆਪਣਾ ਜੀਵਨ ਬਦਲ ਲਿਆ ਉਸ ਨਾਲ ਉਹਦੇ ਵਿੱਚ ਬਹੁਤ ਹੀ ਸਿੱਧੇ ਅਤੇ ਸਟੀਕ ਢੰਗ ਢੰਗ ਦੇ ਜੀਵਨ ਦਾ ਜਾਂ ਇੱਕ ਇਨ ਇਨਸਾਨ ਇੱਕ ਨੌਜਵਾਨ ਮੁੰਡਾ ਆਪਣੇ ਜੀਵਨ 'ਚ ਕੀ ਕਰ ਸਕਦਾ ਕੀ ਰੰਗ ਲਿਆ ਸਕਦਾ ਉਹ ਸਿਰਫ਼ ਉਹਨਾਂ ਨੇ ਉਸ ਕਿਤਾਬ ਵਿੱਚ ਹੀ ਦਰਸਾ ਤਾ ਅਤੇ ਉਸ ਨਾਵਲ ਵਿੱਚ ਹੀ ਦਰਸਾ ਤਾ ਕਿ ਇੱਕ ਇਨਸਾਨ ਇੱਕ ਵਧੀਆ ਚੰਗਾ ਇਨਸਾਨ ਕਿਵੇਂ ਬਣਿਆ ਜਾ ਸਕਦਾ ਹੈ ਉਹ ਨਾਵਲ ਮੇਰੇ ਜਿਹਨ ਉੱਤੇ ਛਪ ਗਿਆ ਅਤੇ ਮੈਨੂੰ ਹੋਰ ਵੀ ਕਈ ਸਾਰੇ ਨਾਵਲ ਚੇਤੇ ਆ ਜਿਹਨਾਂ ਵਿੱਚੋਂ ਕਿ ਗੁਰਦਿਆਲ ਸਿੰਘ ਗੁਰਦਿ ਗੁਰਦਿਆਲ ਸਿੰਘ ਜੀ ਦਾ ਹੈਗਾ ਜਿਵੇਂ ਮੜੀ ਦਾ ਦੀਵਾ ਹੈ ਅਤੇ ਆਪਣੇ ਗੌਰੀ ਨਾਵਲ ਹੈ ਮੈ ਮੈਨੂੰ ਗੌਰੀ ਨਾਵਲ ਤੋਂ ਵੀ ਬਹੁਤ ਜ਼ਿਆਦਾ ਸਿੱਖਿਆ ਮਿਲੀ ਜਿਸ ਵਿੱਚੋਂ ਕਿ ਮੈਂ ਬਹੁਤ ਵਧੀਆ ਆਪਣੇ ਜੀਵਨ ਵਿੱਚ ਇੱਕ ਚੰਗੀ ਸਿੱਖਿਆ ਪ੍ਰਾਪਤ ਕੀਤੀ ਅਤੇ ਅੱਜ ਵੀ ਮੇਰੇ ਜ ਜੇਕਰ ਮੈਂ ਗੌਰੀ ਨਾਵਲ ਨੂੰ ਯਾਦ ਕਰਦਾ ਤਾਂ ਮੇਰੇ ਰੋਂਗਟੇ ਖੜੇ ਹੋ ਜਾਂਦੇ ਕਿ ਕਿਵੇਂ ਕਿਸ ਤਰ੍ਹਾਂ ਉਸਨੇ ਇੱਕ ਔਰਤ ਦੀ ਸਥਿੱਤੀ ਬਾਰੇ ਦੱਸਿਆ ਉਸ ਨਾਵਲ ਵਿੱਚ ਕਿ ਔਰਤ ਕੀ ਕੀ ਆਪਣੇ ਬਚਪਨ ਤੋਂ ਲੈ ਕੇ ਆਪਣੇ ਜਵਾਨੀ ਤੱਕ ਅਤੇ ਬੁਢਾਪੇ ਤੱਕ ਕੀ ਕੀ ਕਿਵੇਂ ਦਾ ਸਹਾਰਦੀ ਹੈ ਆਪਣੇ ਜੀਵਨ ਵਿੱਚ ਉਹ ਸਭ ਮੈਨੂੰ ਇਹਨਾਂ ਨਾਵਲਾਂ ਕਿਤਾਬਾਂ ਪੜ੍ਹ ਕੇ ਹੀ ਪਤਾ ਲੱਗਦਾ ਹੈ ਅਤੇ ਮੈਂ ਨਾ ਅੱਜ ਵੀ ਉੰਨਾ ਹੀ ਪਿਆਰ ਕਿਤਾਬਾਂ ਨੂੰ ਕਰਦਾ ਹਾਂ ਜਿੰਨਾ ਬਚਪਨ 'ਚ ਕਰਦਾ ਸੀ ਅਤੇ ਮੈਨੂੰ ਲੱਗਦਾ ਕਿ ਮੇਰਾ ਬਚਪਨ ਵੀ ਐਵੇਂ ਬੀਤਿਆ ਅਤੇ ਜਵਾਨੀ ਵੀ ਕਿਤਾਬਾਂ ਵਿੱਚ ਬੀਤ ਗਈ ਅਤੇ ਬੁਢਾਪਾ ਵੀ ਮੇਰਾ ਕਿਤਾਬਾਂ ਵਿੱਚ ਹੀ ਜਾਣਾ ਹੈ ਧੰਨਵਾਦ